ਮੈਂ ਆਪਣੀ ਚੱਲ ਰਹੀ ਰੂਟੀਨ ਵਿੱਚ ਤਾਕਤ ਇਸ ਤਰ੍ਹਾਂ ਐਡ ਕਰਦਾ ਹਾਂ ਪਹਿਲਾ ਤਾਂ ਮੈਂ ਜਿੰਮ ਲੱਗਿਆ ਹੋਇਆਂ ਇਸ ਲਈ ਮੈਂ ਵਰਕਿੰਗ 'ਤੇ ਹਾਂ ਮੈਂ ਵਰਕਿੰਗ ਲਈ ਕੁਛ ਡਾਈਟ ਆਪਣੀ ਟਰੇਨਰ ਤੋਂ ਵੀ ਐਡ ਕਰਾਈ ਹੈ ਅਤੇ ਕੁਛ ਜੋ ਕੋਈ ਘਰ ਦੱਸਦਾ ਹੈ ਉਹ ਵੀ ਐਡ ਕਰਦਾ ਹਾਂ ਜਿਵੇਂ ਕਿ ਤਾਕਤ ਲਿਆਉਣ ਲਈ ਪਹਿਲਾਂ ਸਾਨੂੰ ਪੀਨਟ ਬਟਰ ਕੇਲੇ ਅਤੇ ਸੱਤੂ ਪਾਉਡਰ ਦੀ ਲੋੜ ਪੈਂਦੀ ਹੈ ਅਤੇ ਸਾਨੂੰ ਮਿੱਠਾ ਬਿਲਕੁਲ ਬੰਦ ਹੀ ਕਰਨਾ ਪੈਂਦਾ ਹੈ ਖੰਡ ਦੀ ਵਰਤੋਂ ਜਿੰਨੀ ਘੱਟ ਕਰਦੇ ਹਾਂ ਉਨੀ ਆਪਣੇ ਵਿੱਚ ਤਾਕਤ ਆਉਂਦੀ ਹੈ ਕੋਲਡ ਡਰਿੰਕ ਸੋਫਟ ਡਰਿੰਕ ਇਹ ਵੀ ਬੰਦ ਕਰਨੇ ਪੈਂਦੇ ਹਨ ਜੇਕਰ ਅਸੀਂ ਆਪਣੇ ਵਿੱਚ ਤਾਕਤ ਵਧਾਉਣੀ ਹੈ ਜੇਕਰ ਅਸੀਂ ਇੱਕ ਬੋਤਲ ਵੀਹ ਰੁਪਏ ਵਾਲੀ ਕੋਕ ਦੀ ਪੀਂਦੇ ਹਾਂ ਉਹਦੇ 'ਚ ਵੀ ਚਾਰ ਤੋਂ ਪੰਜ ਕੋਲੀਆਂ ਸ਼ੂਗਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਸਾਡੀ ਬਾਡੀ 'ਚ ਕਾਰਬਜ਼ ਵੱਧਦੇ ਹਨ ਅਤੇ ਸਾਨੂੰ ਵਰਕਆਊਟ ਕਰਦਿਆਂ ਨੂੰ ਸਾਹ ਚੜ੍ਹਦਾ ਹੈ ਇਸ ਲਈ ਸਾਨੂੰ ਕੋਲਡ ਡਰਿੰਕ ਦੀ ਵਰਤੋਂ ਬਹੁਤ ਹੀ ਘੱਟ ਕਰਨੀ ਚਾਹੀਦੀ ਕਰਨੀ ਹੀ ਨਹੀਂ ਚਾਹੀਦੀ ਦੂਜੀ ਸਾਨੂੰ ਹੈਲਦੀ ਖਾਣਾ ਖਾਣਾ ਚਾਹੀਦਾ ਹੈ ਜਿਵੇਂ ਕਿ ਬਾਹਰਲੇ ਖਾਣੇ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਜੋ ਘਰੇ ਬਣਦਾ ਹੈ ਉਹ ਤੋਂ ਵੀ ਥੋੜ੍ਹਾ ਪਰਹੇਜ਼ ਰੱਖਣਾ ਚਾਹੀਦਾ ਆਪ ਬਣਾ ਕੇ ਖਾਣਾ ਚਾਹੀਦਾ ਹੈ ਪਹਿਲਾਂ ਜਿਵੇਂ ਕਿ ਦੇਸੀ ਘਿਓ ਦੇ ਤੜਕੇ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਉਬਲਿਆ ਹੋਇਆ ਖਾਣਾ ਹੀ ਖਾਣਾ ਪੈਂਦਾ ਹੈ ਹੁਣ ਆਪਾਂ ਆਉਣੇ ਆ ਸਟਰੈਚਿੰਗ 'ਤੇ ਵਰਕਆਊਟ ਕਰਨ ਤੋਂ ਪਹਿਲਾਂ ਸਟਰੈਚਿੰਗ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਅਸੀਂ ਸਟਰੈਚਿੰਗ ਨਹੀਂ ਕਰਦੇ ਮਸਲ ਸੁੱਤੀ ਹੋਈ ਹੁੰਦੀ ਹੈ ਜਦੋਂ ਇੱਕਦਮ ਅਸੀਂ ਵੇਟ ਚੱਕਦੇ ਹਾਂ ਤਾਂ ਸਾਡੇ ਮਸਲਸ ਕ ਕਰੈਂਪਸ ਆਉਣਾ ਸ਼ੁਰੂ ਹੋ ਜਾਂਦੇ ਹਨ ਇਸ ਲੀਏ ਉਸ ਤੋਂ ਪਹਿਲਾਂ ਸਟਰੈਚਿੰਗ ਕਰਨੀ ਵੀ ਜ਼ਰੂਰੀ ਹੈ ਮੈਂ ਸਟਰੈਚਿੰਗ ਇਸ ਤਰ੍ਹਾਂ ਕਰਦਾ ਜੇਕਰ ਮੈਂ ਬਾਈਸੈਪ ਲਾਉਣੇ ਹੁੰਦੇ ਆ ਤਾਂ ਪਹਿਲਾਂ ਮੈਂ ਘੱਟ ਵੇਟ 'ਚ ਟਰੇਨ ਕਰਨਾ ਸ਼ੁਰੂ ਕਰ ਦਿੰਦਾ ਹਾਂ ਉਨੇ 'ਚ ਸਟਰੈਚਿੰਗ ਹੋ ਜਾਂਦੀ ਹੈ ਜਦੋਂ ਮੈਂ ਕੱਦ ਵਾਲੀਆਂ ਐਸਰਸਾਈਜ਼ਾਂ ਲਾਉਣੀਆਂ ਹੁੰਦੀਆਂ ਹਨ ਉਦੋਂ ਮੈਂ ਪਹਿਲਾਂ ਟਰੈਡਮਿੱਲ ਕਰਦਾ ਹਾਂ ਫਿਰ ਲਮਕਦਾ ਹਾਂ ਉਹ ਤੋਂ ਬਾਅਦ ਬਾਹਾਂ ਨੂੰ ਸਟਰੈਚ ਸਟਰੁਚ ਕਰਕੇ ਉਹ ਤੋਂ ਬਾਅਦ ਸ਼ੁਰੂ ਕਰਦਾ ਹਾਂ ਫਿਰ ਮੈਂ ਕਦੇ ਕਦੇ ਯੋਗਾ ਵੀ ਕਰਦਾ ਹਾਂ ਉਸ ਨਾਲ ਪੈਰਾਂ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਅਤੇ ਉਸ ਨਾਲ ਸਾਹ ਦਾ ਆਉਣਾ ਜਾਣਾ ਵੀ ਸਹੀ ਰੇਟ ਵਿੱਚ ਚੱਲਦਾ ਰਹਿੰਦਾ ਹੈ